ਚੌਦ੍ਹਾਂ ਅਪ੍ਰੈਲ ਦੋ ਹਜ਼ਾਰ ਬਾਈ ਛੱਬੀ ਅਪ੍ਰੈਲ ਦੋ ਹਜ਼ਾਰ ਇੱਕੀ ਚੌਦ੍ਹਾਂ ਫਰਵਰੀ ਦੋ ਹਜ਼ਾਰ ਸੋਲ੍ਹਾਂ ਸਤਾਰ੍ਹਾਂ ਫਰਵਰੀ ਉੱਨੀ ਸੌ ਛਿਆਨਵੇਂ ਤੀਹ ਅਪ੍ਰੈਲ ਉੱਨੀ ਸੌ ਅਠਾਨਵੇਂ